ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਦਲ ਵੱਖ ਵੱਖ ਰਾਜਾਂ ਵਿੱਚ ਸਿੱਖਿਆ ਨੂੰ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਮੇਂ ਸਮੇਂ 'ਤੇ ਸਰਕਾਰ ਵੱਲੋਂ ਯੋਜਨਾਵਾਂ ਚਲਾਈਆਂ ਜਾਂਦੀਆਂ ਨੇ ਜਿਵੇ ਸਾਈਕਲ ਯੋਜਨਾਵਾਂ ਲੈਪਟੋਪ ਲਗਾ ਲਓ ਮੋਬਾਇਲ ਫੋਨ ਯੋਜਨਾਵਾਂ ਇਹ ਚਾਲੂ ਕੀਤੀਆਂ ਜਾਂਦੀਆਂ ਨੇ ਇਹ ਸਕੀਮਾਂ ਕਿਤੇ ਬਹੁਤ ਇਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਕਾਰਗਰ ਸਿੱਧ ਹੁੰਦੀਆਂ ਨੇ ਕਿਉਂਕਿ ਇਸ ਨਾਲ ਜੋ ਲੜਕੀਆਂ ਨੂੰ ਸਿੱਖਿਆ ਖੇਤਰ ਵਿੱਚ ਉਤਸ਼ਾਹਿਤ ਕਰਨ ਵਿੱਚ ਉਤਸ਼ਾਹਿਤ ਕੀਤਾ ਜਾਂਦਾ ਇਸ ਨਾਲ ਲੜਕੀਆਂ ਵਿੱਚ ਪੜ੍ਹਨ ਲਈ ਪੜ੍ਹਨ ਦੀ ਪਰੋਸਟੀ ਪੈਦਾ ਪੈਦਾ ਹੁੰਦੀ ਹੈ ਇਸ ਨਾਲ ਜਿਵੇਂ ਸ ਪੰਜਾਬ ਸਰਕਾਰ 'ਤੇ ਹੀ ਲਾ ਲਓ ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਸਕੀਮ ਤਹਿਤ ਸਾਈਕਲ ਵੰਡੇ ਗਏ ਸੀ ਕਈ ਪਿੰਡਾਂ ਦੇ ਵਿੱਚੋਂ ਲੜਕੀਆਂ ਦੇ ਸੀ ਉਹਨਾਂ ਨੂੰ ਪਿੰਡਾਂ ਵਿੱਚੋਂ ਸਕੂਲ ਤੱਕ ਪਹੁੰਚਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰੰਤੂ ਜਦੋਂ ਸਰਕਾਰ ਵੱਲੋਂ ਇਹਨਾਂ ਕੁੜੀਆਂ ਨੂੰ ਸਾਈਕਲ ਸਾਈਕਲ ਦਿੱਤੇ ਗਏ ਤਾਂ ਇਹਨਾਂ ਨੂੰ ਆਉਣ ਜਾਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਘੱਟ ਕਰਨਾ ਪਿਆ ਇਸ ਤਰ੍ਹਾਂ ਲੈ ਲੈਪਟੋਪ ਸੇਵਾਵਾਂ ਹੋ ਗਈਆਂ ਲੈਪਟੋਪ ਲੈਪਟੋਪ ਕਈ ਸਕੂਲਾਂ ਵਿੱਚ ਬੱਚਿਆਂ ਨੂੰ ਲੈਪਟੋਪ ਵੀ ਦਿੱਤੇ ਗਏ ਲੈਪਟਾਪ ਨਾਲ ਉਹਨਾਂ ਦੇ ਪੜ੍ਹਾਈ ਵਿੱਚ ਉਹਨਾਂ ਦਾ ਮਨ ਲੱਗਣ ਲੱਗ ਗਿਆ ਲੈਪਟੋਪ ਨਾਲ ਇੱਕ ਜੋ ਕਿਉਂਕਿ ਟੈਕਨੋਲਜੀ ਆ ਟੈਕਨੋਲਜੀ ਦੇ ਨਾਲ ਜਿਵੇਂ ਜੀ ਬੱਚਾ ਦੇਖ ਕੇ ਕੁਛ ਕੋ ਕੋਈ ਚੀਜ਼ ਵਰਚੁਲੀ ਦੇਖਦਾ ਤਾਂ ਉਸ ਨਾਲ ਉਹ ਦਾ ਪੜ੍ਹਾਈ ਵਿੱਚ ਮਨ ਜ਼ਿਆਦਾ ਲੱਗਦਾ ਹੈ ਇਸ ਤਰ੍ਹਾਂ ਮੋਬਾਇਲ ਫੋਨ ਸਮਾਰਟ ਫੋਨ ਵੀ ਵੰਡੇ ਗਏ ਮੋ ਸਮਾਰਟ ਫੋਨ ਪੰਜਾਬ ਸਰਕਾਰ ਵੱਲੋਂ ਕੈਪਟਨ ਸਰਕਾਰ ਦੇ ਰ ਰਾਜ ਵਿੱਚ ਸਮਾਰਟ ਫੋਨ ਵੀ ਦਿੱਤੇ ਗਏ ਸਮਾਰਟ ਫੋਨ ਵਿੱਚ ਕੀ ਸੀ ਇਹਨਾਂ ਨੂੰ ਸਮਾਰਟ ਫੋਨ ਦੇ ਵਿੱਚ ਪੜ੍ਹਾਈ ਬੱਚਿਆਂ ਨੂੰ ਪੜ੍ਹਾਈ ਦੇ ਰਿਲੇਟਿਡ ਹੀ ਸਿਰਫ ਪੜ੍ਹਾਈ ਦੇ ਰਿਲੇਟਡ ਐਪਸ ਡਾਊਨਲੋਡ ਕਰਕੇ ਦਿੱਤੀਆਂ ਗਏ ਜਿਸ ਨਾਲ ਵਿਦਿਆਰਥੀਆਂ ਦੇ ਪੜ੍ਹਨ ਵਿੱਚੋਂ ਮਦਦ ਮਿਲੇ ਅਤੇ ਉਹਨਾਂ ਨੂੰ ਵਧੀਆ ਵਧੀਆ ਅੱਗੇ ਜਾ ਕੇ ਵਧੀਆ ਪ੍ਰਦਰਸ਼ਨ ਕਰ ਸਕਣ ਅਤੇ ਆਪਣੇ ਆਪਣੇ ਖੇਤਰ ਵਿੱਚ ਵਧੀਆ ਨਾਮ ਕਮਾ ਸਕਣ ਹਾਂ ਇਹ ਸਕੀਮਾਂ ਨੇ ਕਿਤੇ ਨਾ ਕਿਤੇ ਸ ਪੜ੍ਹਾਈ ਵਿੱਚ ਬਹੁਤ ਕਾਰਗਰ ਸਿੱਧ ਹੁੰਦੀਆਂ ਨੇ ਬੱਚਿਆਂ ਕੁੜੀਆਂ ਦੀ ਸਿੱਖਿਆ ਖ਼ਾਸ ਕਰਕੇ ਕੋ ਲੜਕੀਆਂ ਦੀ ਸਿੱਖਿਆ ਲਈ ਇਹ ਸਕੀਮਾਂ ਬਹੁਤ ਜ਼ਿਆਦਾ ਹੀ ਵਧੀਆਂ ਨੇ ਅਤੇ ਇਹਨਾਂ ਨਾਲ ਲੜਕਿਆਂ ਨਾਲ ਲੜਕਿਆਂ ਨੂੰ ਬਹੁਤ ਵਧੀਆ ਪੜ੍ਹਨ ਲਈ ਮੋਟੀਵੇਸ਼ਨ ਮਿਲਦੀ ਹੈ ਧੰਨਵਾਦ